ਸਤਿ ਸ਼੍ਰੀ ਅਕਾਲ ਜੀ ਮੈਂ ਜੀ ਜਾਣਕਾਰੀ ਪਤਾ ਕਰਨੀ ਸੀ ਕੀ ਲੁਧਿਆਣਾ ਤੋਂ ਕਿੱਥੇ ਕਿੱਥੇ ਕਿਹੜੇ ਕਿਹੜੇ ਸ਼ਹਿਰਾਂ 'ਚ ਬੱਸਾਂ ਜਾਂਦੀਆਂ ਨੇ ਆਪਣੀ ਵੋਲਵੋ ਦੀਆਂ ਅੱਛਾ ਜੀ ਅਤੇ ਬੱਸਾਂ 'ਚ ਅੱਛਾ ਜੀ ਦੱਸੋ ਕੋਈ ਸ਼ੀਟਿੰਗ ਅੱਛਾ ਜੀ ਅੱਛਾ ਠੀਕ ਹੈ ਅਤੇ ਬੱਸਾਂ ਏਸੀ ਰਹਿੰਦੀਆਂ ਆਪਣੀਆਂ ਅੱਛਾ ਜੀ ਠੀਕ ਹੈ ਜੇ ਆਪਾਂ ਥੋੜ੍ਹੀ ਦੂਰ ਸੀਟੀ 'ਚ ਟਰੈਵਲ ਕਰਨਾ ਤਾਂ ਸਲੀਪਿੰਗ ਬੱਸ ਵੀ ਹੋ ਜੇਗੀ ਸਲੀਪਰ ਆਪਣੀ ਢਾਈ ਕੁ ਸੌ ਕਿਲੋਮੀਟਰ ਦੇ ਅੰਡਰ ਅੱਛਾ ਜੀ ਸਲੀਪਰ ਅਤੇ ਕਿੰਨੇ ਟਾਈਮ ਦੀ ਰਹੇਗੀ ਜੀ ਆਪਣੀ ਟਰਿਪ ਇਹ ਅੱਛਾ ਜੀ ਅੱਛਾ ਠੀਕ ਹੈ ਅਤੇ ਬੱਸਾਂ 'ਚ ਮਤਲਬ ਸਾਫ ਸਫਾਈ ਕਿਵੇਂ ਹੁੰਦੀ ਹੈ ਅੱਛਾ ਜੀ ਹੋਰ ਸਰਵਿਸ ਵਗੈਰਾ ਕੋਈ ਪ੍ਰੋਵਾਈਡ ਹੋ ਸਕਦੀ ਜੇ ਬੰਦੇ ਨੇ ਖਾਣ ਪੀਣ ਦਾ ਜੇ ਅਤੇ ਸਟੋਪ ਵਗੈਰਾ ਕਿਵੇਂ ਰਹਿੰਦੀ ਬੱਸ ਅੱਛਾ ਜੀ ਫੇਰ ਖਾਣਾ ਪੀਣਾ ਬੱਸ ਪ੍ਰੋਵਾਈਡ ਅੰਦਰ ਬੱਸ ਦੇ ਅੰਦਰ ਹੀ ਹੁੰਦਾ ਕਿ ਬੱਸ ਨੂੰ ਰੁਕਵਾ ਕੇ ਕਿਸੇ ਹੋਟਲ ਵਗੈਰਾ ਤੇ ਹੁੰਦਾ ਅੱਛਾ ਜੀ ਠੀਕ ਹੈ ਅਤੇ ਇਹਦੇ ਨਾਲ ਮਤਲਬ ਐਕਸਟਰਾ ਚਾਰਜ ਹੀ ਹੋਣਗੇ ਹੈ ਨਾ ਜੀ ਇਹਦੇ ਤਾਂ ਅਤੇ ਅੱਛਾ ਇਹ ਫਿਰ ਬੱਸਾਂ 'ਚ ਮਤਲਬ ਸੀਟਾਂ ਦੀ ਕੰਫਰਟੇਬਲ ਖੁੱਲੀਆਂ ਨੇ ਕਿ ਮਤਲਬ ਜ਼ਿਆਦਾ ਭੀੜੀਆਂ ਭੀੜੀਆਂ ਲੱਗੀਆਂ ਹੋਈਆਂ ਨੇ ਦੇਖੋ ਜੀ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਆਪਾਂ ਨੂੰ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਆਪਾਂ ਨੂੰ ਅਤੇ ਮਤਲਬ ਹਰ ਕਿਹੜੀ ਸੀਟੀ 'ਚ ਹੀ ਕਨੈਕਟ ਹੁੰਦੀ ਹੈ ਨਾ ਇਹ ਚੰਡੀਗੜ੍ਹ ਤੱਕ ਜਾਂਦੀਆਂ ਹੋਣੀਆਂ ਆਪਣੀਆਂ ਅੱਛਾ ਜੇ ਆਪਾਂ ਲੋਂਗ ਰੂਟ ਹੀ ਜਾਣਾ ਹੋਈਏ ਜਿਵੇਂ ਜੈਪੁਰ ਸੀਟੀ ਹੋਏ ਜਾਂ ਕੋਈ ਉੱਤਰਾਖੰਡ 'ਚ ਜਾਣਾ ਹੋਏ ਆਪਾਂ ਵੀ ਉੱਧਰ ਨੂੰ ਵੀ ਰੂਟ ਹੈਗੇ ਜੀ ਅੱਛਾ ਜੀ ਅਤੇ ਉੱਧਰ ਵੀ ਮਤਲਬ ਸਾਰੇ ਕਿੱਥੇ ਆਪਣੀ ਵੀ ਸਾਰਾ ਵਧੀਆ ਅਰੇਂਜਮੈਂਟ ਰਹੇਗਾ ਠੀਕ ਹੈ ਜੀ ਪੈਸੇ ਆਪਣੇ ਮਤਲਬ ਬਾਹਰ ਜਿਹੜੀ ਬੱਸਾਂ ਜਾਂਦੀਆਂ ਉਹਨਾਂ ਦੀ ਟਿਕਟਾਂ ਤਾਂ ਫੇਰ ਲੋਕਲ ਨਾਲੋਂ ਮਹਿੰਗੀਆਂ ਹੀ ਹੁੰਦੀਆਂ ਹੋਣੀਆਂ ਹੈ ਨਾ ਜੀ

ਅੱਛਾ ਜੀ ਅੱਛਾ ਇਹ ਤਾਂ ਬਹੁਤ ਰੀਜ਼ਨੇਬਲ ਹੀ ਰੇਟ ਹੈ ਜੀ ਵਧੀਆ ਰੇਟ ਹੈ ਅੱਛਾ ਕਿੰਨੇ ਕਿਲੋਮੀਟਰ ਤੱਕ ਤੇਰ੍ਹਾਂ ਸੌ ਰੁਪਇਆ ਰੇਟ ਰਹਿੰਦਾ ਜੀ ਅੱਛਾ ਜੀ ਅੱਛਾ ਚਲੋ ਫੇਰ ਤਾਂ ਵਧੀਆ ਜੀ ਇੱਕਦਮ ਇਹ ਬਾਕੀ ਹੋਰ ਸੁਣਾਓ ਜੀ ਠੀਕ ਹੈ ਜੀ ਫਿਰ ਮੈਂ ਤੁਹਾਨੂੰ ਅੱਗੇ ਕੰਟੈਕਟ ਕਰਦਾ ਆ ਜਦੋਂ ਵੀ ਪਲੈਨ ਬਣਿਆ ਠੀਕ ਹੈ ਜੀ